ਜਦੋਂ ਸਾਨੂੰ ਥੋੜ੍ਹੇ ਦਿਨਾਂ ਲਈ ਬਾਹਰ ਜਾਣਾ ਪੈਂਦਾ ਤਾਂ ਅਸੀਂ ਪੌਦਿਆਂ ਦੀ ਦੇਖਭਾਲ ਲਈ ਪਿੱਛੇ ਆਪਣਾ ਪਰਿਵਾਰਕ ਮੈਂਬਰ ਛੱਡ ਕੇ ਜਾਂਦੇ ਹਾਂ ਤਾਂ ਜੋ ਸਾਨੂੰ ਦੁਬਾਰਾ ਆ ਕੇ ਪੌਦਿਆਂ ਦੀ ਦੇਖਭਾਲ ਵਿੱਚ ਕੋਈ ਕਮੀ ਨਾ ਲੱਗੇ ਉਹ ਸਾਡੀ ਗੈਰ ਹਾਜ਼ਰੀ ਦੇ ਵਿੱਚ ਸਮੇਂ ਸਮੇਂ ਸਿਰ ਪੌਦਿਆਂ ਨੂੰ ਪਾਣੀ ਦਿੰਦੇ ਆ ਅਤੇ ਜੋ ਵੀ ਉਹਨਾਂ ਨੂੰ ਲੋੜੀਂਦੀ ਖਾਦ ਜੈਵਿਕ ਖਾਦ ਸੀ ਟੀ ਕੰਪੋਸਟ ਜੋ ਵੀ ਲੋੜੀਂਦਾ ਬਣਦੀ ਹੈ ਉਹ ਪੌਦਿਆਂ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਜਾਂਦੀ ਹੈ ਅਤੇ ਅਗਰ ਸਾਨੂੰ ਬਾਹਰ ਜਾ ਕੇ ਜ਼ਿਆਦਾ ਦਿਨ ਲੱਗ ਜਾਂਦੇ ਹਨ ਤਾਂ ਅਸੀਂ ਸਮੇਂ ਸਮੇਂ 'ਤੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਪੁੱਛਦੇ ਹਾਂ ਕਿ ਸਾਡੇ ਪੌਦੇ ਸਹੀ ਹਨ ਅਤੇ ਉਹ ਸਾਨੂੰ ਸਮੇਂ ਸਮੇਂ 'ਤੇ ਸੂਚਿਤ ਕਰਦੇ ਰਹਿੰਦੇ ਨੇੇ ਅਤੇ ਇੱਕ ਟਾਈਮ ਟੇਬਲ ਦੇ ਹਿਸਾਬ ਨਾਲ ਅਸੀਂ ਪੌਦਿਆਂ ਨੂੰ ਹਰ ਇੱਕ ਚੀਜ਼ ਆਦਾਨ ਪ੍ਰਦਾਨ ਕਰਦੇ ਹਾਂ ਚਾਹੇ ਜੀ ਉਹ ਪਾਣੀ ਹੈ ਚਾਹੇ ਜੀ ਉਹ ਖਾਦ ਹੈ ਚਾਹੇ ਜੀ ਉਹ ਮਿੱਟੀ ਹੈ ਮਿੱਟੀ ਨੂੰ ਛਾਣ ਕੇ ਅਤੇ ਜੈਵਿਕ ਖਾਦ ਅਤੇ ਕੰਪੋਸਟ ਸਿ ਟੀ ਕੰਪੋਸਟ ਨੂੰ ਉਹਨਾਂ ਨੂੰ ਸਮੇਂ ਸਮੇਂ ਸਿਰ ਪੌਦਿਆਂ ਨੂੰ ਦਿੰਦੇ ਹਾਂ ਅਤੇ ਜੇਕਰ ਕੋਈ ਪੌਦੇ ਨੂੰ ਬਿਮਾਰੀ ਪੈ ਜਾਂਦੀ ਹੈ ਤਾਂ ਅਸੀਂ ਖੇਤੀਬਾੜੀ ਵਿਭਾਗ ਵਿੱਚ ਮਦਦ ਉਹਨਾਂ ਤੋਂ ਮਦਦ ਵੀ ਲੈਂਦੇ ਹਾਂ ਅਤੇ ਸਮੇਂ ਸਮੇਂ ਸਿਰ ਪੌਦੇ ਨੂੰ ਅਸੀਂ ਸਹੀ ਤਰੀਕੇ ਨਾਲ ਉਹਨਾਂ ਦੀ ਸੰਭਾਲ ਕਰਦੇ ਹਾਂ ਧੰਨਵਾਦ